ਮੋਹਾਲੀ ਸ਼ਹਿਰ ਵਿੱਚ ਮਨਾਏ ਜਾਣ ਵਾਲੇ ਮੁੱਖ ਤਿਉਹਾਰ ਦੀਵਾਲੀ ਹੋਲੀ ਦੁਸਹਿਰਾ ਦੀਵਾਲੀ ਦੀਵਾਲੀ ਵਾਲੇ ਦਿਨ ਸਾਰੇ ਰਾਤ ਨੂੰ ਆਪਣੇ ਘਰ ਵਿੱਚ ਘੀ ਦੇ ਦੀਵੇ ਜਗਾਉਂਦੇ ਹਨ ਬੱਚੇ ਪਟਾਖੇ ਜਲਾ ਕੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ ਦੁਸਹਿਰਾ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਫੂਕਦੇ ਹਨ ਅਤੇ ਲੋਕ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹਨ ਹੋਲੀ ਹੋਲੀ ਰੰਗਾਂ ਦਾ ਤਿਉਹਾਰ ਹੈ ਇਸ ਦਿਨ ਸਾਰੇ ਇੱਕ ਦੂਜੇ ਨੂੰ ਹੋਲੀ 'ਤੇ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਉਂਦੇ ਹਨ ਜਨਮ ਅਸ਼ਟਮੀ ਜਿਵੇਂ ਕਿ ਜਨਮ ਅਸ਼ਟਮੀ ਆਉਣ ਵਾਲੀ ਹੈ ਜਨਮ ਅਸ਼ਟਮੀ ਵਾਲੇ ਦਿਨ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਉਤਸਵ 'ਤੇ ਲੋਕ ਬਾਰ੍ਹਾਂ ਵਜੇ ਰਾਤ ਨੂੰ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਝੁਲਾਉਂਦੇ ਹਨ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਂਦੇ ਹਨ ਵਿਸਾਖੀ ਵਿਸਾਖੀ ਕਿਸਾਨਾਂ ਦਾ ਮੁੱਖ ਤਿਉਹਾਰ ਹੈ ਹਾੜ੍ਹੀ ਦੀ ਫਸਲ ਪੱਕਣ 'ਤੇ ਲੋਕ ਖੁਸ਼ੀ ਖੁਸ਼ੀ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ ਘਰ ਵਿੱਚ ਨਵੀਂ ਫਸਲ ਆਉਣ 'ਤੇ ਲੋਕ ਵਿਸਾਖੀ ਵਾਲੇ ਦਿਨ ਭੰਗੜਾ ਪਾਉਂਦੇ ਹਨ ਖੁਸ਼ੀ ਖੁਸ਼ੀ ਵਿਸਾਖੀ ਦੇ ਤਿਉਹਾਰ ਨੂੰ ਬੜੇ ਉਤਸਵ ਨਾਲ ਮਨਾਉਂਦੇ ਹਨ ਇਹ ਮੋਹਾਲੀ ਦੇ ਜ਼ਿਲ੍ਹੇ ਦੇ ਮੁੱਖ ਤਿਉਹਾਰ ਹਨ ਜਿ ਜਿਨ੍ਹਾਂ ਨੂੰ ਲੋਕ ਬੜੇ ਹੀ ਸੱਭਿਆਚਾਰਕ ਅਤੇ ਵਧੀਆ ਤਰੀਕੇ ਨਾਲ ਮਨਾਉਂਦੇ ਹਨ